ਪਿਛਲੇ ਸਾਲਾਂ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਵਿੱਚ ਬਹੁਤ ਹੀ ਜ਼ਿਆਦਾ ਬਦਲਾਵ ਦੇਖਣ ਨੂੰ ਮਿਲਿਆ ਹੈ ਕਿਉਂਕਿ ਪਿਛਲੇ ਕੁਝ ਸਾਲ ਜਿਹੜਾ ਹੈਗਾ ਇੱਕ ਵੀ ਅਮਿਤ ਸ਼ਾਹ ਜਿਹੜਾ ਉਹ ਕਾਂਗਰਸ ਲੀਡਰ ਹੈਗਾ ਉਹਨਾਂ ਨੇ ਕਾਫੀ ਪਠਾਨਕੋਟ ਦੇ ਢਾਂਚੇ ਨੂੰ ਬਦਲਿਆ ਜਗ੍ਹਾ ਜਗ੍ਹਾ ਸਟਰੀਟ ਲਾਈਟਾਂ ਦੇ ਨਾਲ ਇਹਨੂੰ ਸੰਵਾਰਿਆ ਸੜਕਾਂ ਨਵੀਆਂ ਬਣਾਈਆਂ ਨਵੇਂ ਰੈਸਟੋਰੈਂਟ ਖੋਲ੍ਹੇ ਠੀਕ ਹੈ ਉਹਦੇ ਨਾਲ ਜਿਹੜਾ ਪਠਾਨਕੋਟ ਹੈ ਉਹਦੇ ਵਿੱਚ ਕਾਫੀ ਤਬਦੀਲੀ ਆਈ ਅਤੇ ਇਹ ਤਾਂ ਉਹਨਾਂ ਦਾ ਜਿਹੜਾ ਹੈਗਾ ਇੱਕ ਖਾਸ ਯੋਗਦਾਨ ਹੈ ਅਤੇ ਜਿਹੜਾ ਇਹਨਾਂ ਚੀਜ਼ਾਂ ਦਾ ਉੱਥੇ ਰਹਿਣ ਵਾਲੇ ਜਿਹੜੇ ਸਾਡੇ ਲੋਕ ਹੈ ਉਹਨਾਂ 'ਤੇ ਵੀ ਕਾਫੀ ਪ੍ਰਭਾਵ ਪਿਆ ਹੈ ਲੋਕ ਕਾਫੀ ਖੁਸ਼ ਹਨ ਹੋਏ ਹਨ ਕਿ ਉਹਨਾਂ ਨੂੰ ਜਿਹੜੀਆਂ ਇਹ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਮਿਲੀਆਂ ਹਨ ਨਵੇਂ ਨਵੇਂ ਨਵੇਂ ਜਿਹੜੇ ਰੈਸਟੋਰੈਂਟ ਖੋਲ੍ਹਣ ਕਰਕੇ ਲੋਕਾਂ ਨੂੰ ਕਾਫੀ ਬਿਜ਼ਨਸ ਮਿਲੇ ਹਨ ਜਾਂ ਕੰਮ ਮਿਲਿਆ ਹੈ ਇਸ ਕਰਕੇ ਇਹ ਤਬਦੀਲੀਆਂ ਜਿਹੜੀਆਂ ਜ਼ਿਆਦਾਤਰ ਆਈਆਂ ਹਨ